ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਖੇਤੀ ਮੱਛੀ ਪਾਲਣ ਪਸ਼ੂ ਪਾਲਣ ਡੇਰੀ ਉਤਪਾਦਨ ਵਿੱਚ ਅਤੇ ਖੇਤੀਬਾੜੀ ਵਿੱਚ ਤਕਨੋਲਜੀ ਨੇ ਕਿਵੇਂ ਮਦਦ ਕੀਤੀ ਹੈ ਤਕਨੋਲਜੀ ਨੇ ਇਹਨਾਂ ਸਾਰੀਆਂ ਹੀ ਥਾਵਾਂ ਉੱਤੇ ਬਹੁਤ ਜ਼ਿਆਦਾ ਮਦਦ ਕੀਤੀ ਹੈ ਜਿਵੇਂ ਕਿ ਖੇਤੀ ਵਿੱਚ ਪਹਿਲਾਂ ਲੋਕ ਪਸ਼ੂਆਂ ਨਾਲ ਹੱਲ ਵਾਹੁੰਦੇ ਸਨ ਅਤੇ ਪਾਣੀ ਲਈ ਮੀਂਹ ਸਿੰਚਾਈ ਲਈ ਮੀਂਹ ਨੂੰ ਉਡੀਕਦੇ ਸਨ ਪਰ ਹੁਣ ਤਕਨੋਲਜੀ ਦੇ ਆਉਣ ਕਰਕੇ ਖੇਤੀ ਵਿੱਚ ਟਰੈਕਟਰ ਆ ਗਏ ਹਨ ਅਤੇ ਪਸ਼ੂਆਂ ਦਾ ਜ਼ੋਰ ਨਹੀਂ ਲੱਗਦਾ ਹੈ ਟਰੈਕਟਰਾਂ ਨਾਲ ਵਾਹੀ ਡੂੰਘੀ ਅਤੇ ਜ਼ਿਆਦਾ ਛੇਤੀ ਹੋ ਜਾਂਦੀ ਹੈ ਅਤੇ ਇਸ ਨਾਲ ਪਸ਼ੂਆਂ ਨੂੰ ਵੀ ਹਾ ਹਾਨੀ ਨਹੀਂ ਪਹੁੰਚਦੀ ਪਸ਼ੂ ਪਾਲਣ ਵਿੱਚ ਵੀ ਤਕਨੋਲਜੀ ਨੇ ਬਹੁਤ ਹੀ ਮਦਦ ਕੀਤੀ ਹੈ ਪਸ਼ੂਆਂ ਨੂੰ ਟਾਇਮ ਸਿਰ 'ਤੇ ਖਾਣਾ ਆਪੇ ਤਕਨੋਲਜੀ ਨਾਲ ਮਿਲ ਜਾਂਦਾ ਹੈ ਅਤੇ ਤਕਨੋਲਜੀ ਕਰਕੇ ਪਸ਼ੂਆਂ ਦਾ ਦੁੱਧ ਚੋਣਾਂ ਵੀ ਸ ਆਸਾਨ ਹੋ ਚੁੱਕਿਆ ਹੈ ਮ ਆਪਾਂ ਪਸ਼ੂਆਂ ਦੇ ਤ ਥਣਾਂ ਉੱਥੇ ਮਸ਼ੀਨਾਂ ਲਾ ਕੇ ਉਹਨਾਂ ਦਾ ਦੁੱਧ ਮਿੰਟਾਂ ਵਿੱਚ ਚੋ ਸਕਦੇ ਹਾਂ ਅਤੇ ਡੇਰੀ ਉਤਪਾਦਨ ਵਿੱਚ ਤਕਨੋਲਜੀ ਨੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ ਡੇਰੀ ਵਾਲੇ ਪ੍ਰੋਡਕਟ ਤਕਨੋਲਜੀ ਕਾਰਨ ਛੇਤੀ ਬਣ ਜਾਂਦੇ ਹਨ ਦੁੱਧ 'ਚੋਂ ਆਪੇ ਹੀ ਘੀ ਨਿਕਲ ਜਾਂਦਾ ਹੈ ਦਹੀਂ ਬਣ ਜਾਂਦਾ ਹੈ ਲੱਸੀ ਆਪੇ ਤਕਨੋਲਜੀ ਕਾਰਨ ਬਣ ਜਾਂਦੇ ਹਨ ਇਸ ਕਾਰਨ ਬੰਦਿਆਂ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪੈਂਦਾ ਬਹੁਤ ਹੀ ਚੀਜ਼ਾਂ ਹੁਣ ਸੌਖੀਆਂ ਹੋ ਗਈਆਂ ਹਨ ਜੋ ਕਿ ਪਹਿਲਾਂ ਬੰਦਿਆਂ ਨੂੰ ਕੰਮ ਕਰਨਾ ਪੈਂਦਾ ਸੀ ਹੁਣ ਉਹ ਤਕਨੋਲਜੀ ਕਾਰਨ ਮਸ਼ੀਨਾਂ ਕਾਰਨ ਸੌਖੀਆਂ ਹੋ ਗਈਆਂ ਹਨ ਧੰਨਵਾਦ